ਲਗਭਗ ਅੱਜ ਤੋਂ ਇੱਕ ਸਾਲ ਪਹਿਲਾਂ ਮੈਂ ਕਿਤਾਬ ਪੜ੍ਹੀ ਸੀ ਜਿਸ ਵਿੱਚ ਲਿਟਰਲ ਥਿੰਕਿੰਗ ਬਾਰੇ ਦੱਸਿਆ ਗਿਆ ਸੀ ਇਹ ਕਹਾਣੀ ਬੌਧਿਕ ਤੌਰ 'ਤੇ ਪੜ੍ਹਨ ਵਾਲੇ ਨੂੰ ਚੁਣੌਤੀ ਦਿੰਦੀ ਹੈ ਅਤੇ ਦੱਸਦੀ ਹੈ ਕਿ ਕਿਵੇਂ ਹਾਂ ਅਤੇ ਨਾਂ ਦੇ ਵਿਚਕਾਰ ਵੀ ਇੱਕ ਰਾਹ ਹੁੰਦਾ ਹੈ ਜਿਸ ਨੂੰ ਚੁਣ ਕੇ ਅਤੇ ਜਿਸ ਦੀ ਵਰਤੋਂ ਕਰਕੇ ਜੇ ਨਫ਼ਾ ਨਾ ਹੋਵੇ ਤਾਂ ਨੁਕਸਾਨ ਤੋਂ ਕਿਵੇਂ ਬਚਣਾ ਹੈ